ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਆਪਣੇ ਨਾ ਸਾਇੰਸ ਪ੍ਰੋਜੈਕਟ ਦੇ ਲਈ ਕੁਛ ਸਮਾਨ ਲੈਣਾ ਸੀਗਾ ਤੁਹਾਡੀ ਸ਼ੋਪ ਤੋਂ ਮੈਮ ਬੱਚੇ ਨੇ ਨਾ ਸਾਇੰਸ ਦੇ ਲਈ ਪ੍ਰੋਜੈਕਟ ਬਣਾਉਣਾ ਅਰਥਕਵਿਕ ਅਤੇ ਉਹਦੇ ਲਈ ਇੱਕ ਤਾਂ ਥਰਮਾਕੋਲ ਚਾਹੀਦਾ ਸੀਗਾ ਇੱਕ ਤੁਸੀਂ ਬਲੈਕ ਕਲਰ ਦਾ ਚਾਟ ਦੇ ਦਿਓ ਅੱਜ ਇੱਕ ਤੁਸੀਂ ਵਾਈਟ ਕਲਰ ਦਾ ਚਾਰਟ ਦੇ ਦਿਓ ਮੈਮ ਤੁਹਾਡੇ ਕੋਲ ਆਰਟੀਫਿਸ਼ਅਲ ਟ੍ਰੀ ਮਿਲ ਜਾਣੇ ਆ ਇੱਕ ਤੁਸੀਂ ਆਰਟੀਫਿਸ਼ਅਲ ਟ੍ਰੀ ਕਰ ਦਿਓ ਪੰਜ ਕਰ ਦਿਓ ਅਤੇ ਇੱਕ ਸਾਨੂੰ ਬਿਲਡਿੰਗ ਬਣਾਉਣੀ ਆਂ ਅਸੀਂ ਉਹਦੇ ਲਈ ਤੁਸੀਂ ਸਾਨੂੰ ਆਈਸਕ੍ਰੀਮ ਸਟੀਕਸ ਦੇ ਦਿਓ ਉਹ ਵੀ ਓਕੇ ਹਾਂਜੀ ਮੈਮ ਕਲਰ ਹਾਂਜੀ ਹਾਂਜੀ ਮੈਮ ਪਿੰਕ ਅਤੇ ਗਰੀਨ ਕਲਰ ਦੀ ਤੁਸੀਂ ਟੇਪ ਵੀ ਪਾ ਦਿਓ ਇਸ ਤੋਂ ਇਲਾਵਾ ਮੈਮ ਤੁਸੀਂ ਇੱਕ ਪੈੱਨਸਿਲ ਸ਼ੋਪਨਰ ਅਤੇ ਕੁਛ ਕਲਰ ਪੈੱਨਸਿਲ ਕਰਓਨ ਵਾਲੀਆਂ ਉਹ ਵੀ ਪਾ ਦਿਓ ਮੈਮ ਇੱਕ ਤੁਹਾਡੇ ਕੋਲ ਪਿੰਕ ਕਲਰ ਦਾ ਚਾਟ ਮਿਲ ਜਾਣਾ ਓਕੇ ਮੈਮ ਉਹ ਵੀ ਪਾ ਦਿਓ ਮੈਮ ਇੱਕ ਅਰਥਕਵਿਕ ਦੇ ਲਈ ਸਾਨੂੰ ਇੱਕ ਛੋਟੀ ਵਾਲੀ ਮੋਟਰ ਚਾਹੀਦੀ ਆ ਜਿਹਦੇ ਨਾਲ ਉਹ ਅਰਥਕਵਿਕ ਓਨ ਹੋਊਗਾ ਮੈਮ ਇੱਕ ਛੋਟੀ ਵਾਲੀ ਮੋ ਹਾਂਜੀ ਹਾਂਜੀ ਮੋਟਰ ਵੀ ਉਹ ਵੀ ਪਾ ਦਿਓ ਐਂਡ ਹੋਰ ਇੱਕ ਮੈਮ ਮੈਂ ਤੁਹਾਡੇ ਕੋਲ ਇੱਕ ਪੁੱਛਣਾ ਸੀਗਾ ਕਿ ਤੁਹਾਡੇ ਕੋਲ ਏਟਥ ਕਲਾਸ ਦੀਆਂ ਬੁੱਕਸ ਮਿਲ ਜਾਣੀਆਂ ਸੈਕਿੰਡ ਹੈਂਡ ਠੀਕ ਹੈ ਮੈਮ ਮੈਮ ਕਿਹੜੇ ਸੈਸ਼ਨ ਦੀਆਂ ਠੀਕ ਹੈ ਮੈਮ ਇਸ ਤੋਂ ਨਿਊ ਅਪ ਅਪ ਵਰਜ਼ਨ ਦਾ ਨਹੀਂ ਹੋਊਗਾ ਤੁਹਾਡੇ ਕੋਲ ਓਕੇ ਮੈਮ ਮੈਮ ਹਾਂਜੀ ਮੈਮ ਜਿਹੜਾ ਆਪਣੇ ਕੋਲ ਸੈਕਿੰਡ ਵਰਜ਼ਨ ਆ ਇਹਦੇ ਵਿੱਚ ਆਪਾਂ ਨੂੰ ਕੀ ਪ੍ਰਾਈਜ਼ ਪਊਗਾ ਏਟਥ ਕਲਾਸ ਦੀਆਂ ਸਾਰੀ ਬੁੱਕਸ ਦੀਆਂ ਓਕੇ ਮੈਮ ਔਰ ਮੈਮ ਜੇ ਮੈਂ ਨਿਊ ਵਨ ਹੀ ਲੈਣੀਆ ਹੋਣ ਤਾਂ ਉਹਦੇ ਲਈ ਮੈਨੂੰ ਕੀ ਪ੍ਰਾਈਜ਼ ਪਊਗਾ ਓਕੇ ਓਕੇ ਮੈਮ ਠੀਕ ਆ ਇੱਕ ਮੈਮ ਤੁਹਾਡੇ ਕੋਲ ਮੈਂ ਪੁੱਛਣਾ ਸੀਗਾ ਕਿ ਤੁਹਾਡੇ ਕੋਲ ਜਿਹੜਾ ਫਿਫਥ ਕਲਾਸ ਦੀ ਵੀ ਬੁੱਕਸ ਮਿਲ ਜਾਣੀਆਂ ਕਿਉਂਕਿ ਮੇਰੀ ਕੁੜੀ ਵਾਸਤੇ ਵੀ ਮੈਨੂੰ ਇਹ ਚਾਹੀਦੀਆਂ ਸੀਗੀਆਂ ਉਹ ਫਿਫਥ ਸਟੈਂਡਰਡ ਦੇ ਵਿੱਚ ਹੈ ਨੈਕਸਟ ਈਅਰ ਉਹਨੇ ਹੋ ਜਾਣਾ ਉਹਦੇ ਲਈ ਓਕੇ ਔਰ ਇਹ ਫਿਫਥ ਸਟੈਂਡਰਡ ਦੀ ਬੁੱਕ ਸੈਕਿੰਡ ਹੈਂਡ ਦਾ ਕੀ ਪ੍ਰਾਈਜ਼ ਪਊਗਾ ਆਪਾਂ ਨੂੰ ਮੈਮ ਸੈਕਿੰਡ ਹੈਂਡ ਜਿਹੜੀਆਂ ਬੁੱਕਸ ਆ ਇਹਨਾਂ ਦਾ ਪ੍ਰਾਈਜ਼ ਕੀ ਪਊਗਾ ਫਿਫਥ ਕਲਾਸ ਲਈ ਹਾਂਜੀ ਹਾਂਜੀ ਓਕੇ ਓਕੇ ਮੈਮ ਠੀਕ ਆ ਔਰ ਮੈਮ ਜਿਹੜਾ ਮੈਂ ਤੁਹਾਡੇ ਕੋਲ ਸਮਾਨ ਲਿਆ ਵਾ ਇਹਦੀ ਬਿਲਿੰਗ ਕਰ ਦਓ ਆਪਾਂ ਦੋ ਕੁ ਦੋ ਟੇਪ ਲਈਆਂ ਸੀਗੀਆਂ ਕਲਰਫੁੱਲ ਫਾਈਵ ਮੈਂ ਤੁਹਾਨੂੰ ਟ੍ਰੀ ਕਿਹਾ ਵਾ ਇੱਕ ਥਰਮਾਕੋਲ ਕਿਹਾ ਇੱਕ ਪਿੰਕ ਕਲਰ ਦਾ ਪੇਪਰ ਕਿਹਾ ਵਾ ਇੱਕ ਬਲੈਕ ਕਲਰ ਦਾ ਕਿਹਾ ਇੱਕ ਵਾਈਟ ਕਲਰ ਦਾ ਕੁਛ ਬਿਲਡਿੰਗਸ ਦੇ ਲਈ ਪੇਪਰ ਕਿਹਾ ਆ ਇੱਕ ਆਈਸਕ੍ਰੀਮ ਸਟੀਕਾਂ ਔਰ ਇੱਕ ਮੈਂ ਤੁਹਾਨੂੰ ਮੋਟਰ ਬਾਰੇ ਕਿਹਾ ਸੀਗਾ ਇਹਨਾਂ ਦੀ ਬਿਲਿੰਗ ਕਰ ਦਿਓ ਤੁਸੀਂ ਓਕੇ ਮੈਮ ਕੋਈ ਲੈਸ ਨਹੀਂ ਕਰੋਗੇ ਤੁਹਾਡੇ ਪੁਰਾਣੇ ਕਸਟਮਰ ਆ ਓਕੇ ਓਕੇ ਮੈਮ ਠੀਕ ਆ ਕਰ ਦਿਓ ਪੈਕ ਮੈਮ ਥੈਂਕ ਯੂ ਮੈਮ